ਪੰਜਾਬ ਵਿੱਚ ਬਹੁਤ ਸਾਰੀਆਂ ਹੀ ਕਲਾਵਾਂ ਪਾਈਆਂ ਜਾਂਦੀਆਂ ਹਨ ਜਿਸ ਵਿੱਚ ਬਹੁਤ ਹੀ ਪ੍ਰਸਿੱਧ ਪੇਂਟਿੰਗ ਮੂਰਤੀ ਅਤੇ ਮਿੱਟੀ ਦੇ ਬਰਤਨ ਬਣਾਉਣਾ ਹੈ ਇਹ ਕਲਾ ਕਿਸੇ ਕਿਸੇ ਕੋਲ ਹੀ ਹੁੰਦੀ ਹੈ ਪੰਜਾਬ ਵਿ ਨੂੰ ਕਲਾਵਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਪੰਜਾਬ ਵਿੱਚ ਕਈ ਸਾਰੇ ਸ਼ਿਲਪਕਾਰ ਦੀ ਵਿਆਖਿਆ ਕਰਨਾ ਬਹੁਤ ਹੀ ਮੁਸ਼ਕਿਲ ਹੈ ਜਿੰਨ੍ਹਾਂ ਨੇ ਬਹੁਤ ਸਾਰੀਆਂ ਹੀ ਮੂਰਤੀਆਂ ਪੇਂਟਿੰਗਸ ਅਤੇ ਮਿੱਟੀ ਦੇ ਬਰਤਨ ਬਣਾਏ ਹਨ ਜੋ ਕਿ ਬਹੁਤ ਹੀ ਸੋਹਣੇ ਅਤੇ ਬਹੁਤ ਹੀ ਵਧੀਆ ਹੁੰਦੇ ਹਨ ਇਹਨਾਂ ਦੀ ਵਿਆਖਿਆ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ ਇਹ ਸ਼ਿਲਪਕਾਰ ਬਹੁਤ ਹੀ ਬਰੀਕੀ ਨਾਲ ਆਪਣਾ ਕੰਮ ਕਰਦੇ ਹਨ ਜਿਹੜਾ ਕਿ ਲੋਕਾਂ ਨੂੰ ਬਹੁਤ ਹੀ ਪਸੰਦ ਆਉਂਦਾ ਹੈ ਲੋਕਾਂ ਇਹ ਲੋਕ ਇਹਨਾਂ ਦੀਆਂ ਪੇਂਟਿੰਗ ਅਤੇ ਮੂਰਤੀਆਂ ਨੂੰ ਕਈ ਸਾਰੇ ਪੈਸੇ ਦੇ ਕੇ ਵੀ ਖਰੀਦਦੇ ਹਨ ਜੋ ਕਿ ਇੱਕ ਉਹਨਾਂ ਦੇ ਪ੍ਰਤੀ ਆਦਰ ਅਤੇ ਉਹਨਾਂ ਦੇ ਪ੍ਰਤੀ ਸਤਿਕਾਰ ਦੀ ਗੱਲ ਹੈ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਵੱਖ ਵੱਖ ਕਿਸਮਾਂ ਦੀਆਂ ਕਲਾ ਅਤੇ ਸ਼ਿਲਪਕਾਰੀਆਂ ਪਾਈਆਂ ਜਾਂਦੀਆਂ ਹਨ ਇਹਨਾਂ ਸ਼ਿਲਪਕਾਰਾਂ ਦਾ ਬਿਆ ਇਹਨਾਂ ਸ਼ਿਲਪਕਾਰਾਂ ਨੂੰ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ ਇਹਨਾਂ ਦੇ ਕਲਾ ਵਿੱਚ ਬਹੁਤ ਹੀ ਬਰੀਕੀ ਅਤੇ ਬਹੁਤ ਹੀ ਪਿਆਰ ਹੁੰਦਾ ਹੈ ਜੋ ਕਿ ਲੋਕਾਂ ਨੂੰ ਆਪਣੇ ਵੱਲ ਮੋਹਿਤ ਕਰਦਾ ਹੈ ਇਹ ਸ਼ਿਲਪਕਾਰ ਬਹੁਤ ਸਾਰੀਆਂ ਪੇਂਟਿੰਗਾਂ ਮੂਰਤੀਆਂ ਟੈਕਸਟਾਈਲਸ ਅਤੇ ਮਿੱਟੀ ਦੇ ਬਰਤਨ ਬਣਾਉਣ ਵਿੱਚ ਮਾਹਿਰ ਹੁੰਦੇ ਹਨ ਅੱਜ ਕੱਲ੍ਹ ਤਾਂ ਇਹਨਾਂ ਵਰਗੇ ਸ਼ਿਲਪਕਾਰ ਮਿਲਣੇ ਬਹੁਤ ਹੀ ਮੁਸ਼ਕਿਲ ਹੋ ਗਏ ਹਨ